ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਹਰਦਿਆਲ ਸਿੰਘ ਗੱਲ ਕਰ ਰਿਹਾ ਜੀ ਤੁਹਾਡਾ ਨਵਾਂ ਗਆਂਢੀ ਬਹੁਤ ਵਧੀਆ ਜੀ ਬਹੁਤ ਵਧੀਆ ਅਤੇ ਮੈਂ ਨਾ ਪੁੱਛਣਾ ਚਾਹੁੰਦਾ ਸੀਗਾ ਵੀ ਅਸੀਂ ਇੱਥੇ ਨਵੇਂ ਹਾਂ ਅਤੇ ਅਸੀਂ ਜਿੱਦਾਂ ਕਿ ਦੁੱਧ ਲਗਵਾਉਣਾ ਅਤੇ ਦਹੀਂ ਵਗੈਰਾ ਦੁੱਧ ਦੇ ਜੋ ਵੀ ਸਮਾ ਆਪਣੇ ਇੱਦਾਂ ਦਾ ਸਮਾਨ ਆਉਂਦਾ ਹੈਗਾ ਅਤੇ ਜਿੱਦਾਂ ਰਸੌਈ ਦਾ ਸਮਾਨ ਹੋ ਗਿਆ ਉਹ ਲੈ ਕੇ ਆਉਣਾ ਜੀ ਤੁਸੀਂ ਦੱਸੋ ਵੀ ਇੱਥੇ ਵਧੀਆ ਕਿਹੜਾ ਜਾਂ ਤਾ ਤੁਸੀਂ ਕਿੱਥੋਂ ਲੈਂਦੇ ਹੋ ਹਾਂਜੀ ਅੱਛਾ ਕੀ ਹਾਂਜੀ ਹਾਂਜੀ ਕੀ ਰੇਟ ਦਿੰਦਾ ਜੀ ਦੁੱਧ ਉਹ ਹਾਂਜੀ ਹਾਂਜੀ ਹਾਂਜੀ

ਅੱਛਾ ਅੱਛਾ ਜੀ ਹਾਂਜੀ

ਹਾਂਜੀ ਹਾਂਜੀ

ਅੱਛਾ ਜੀ ਪਨੀਰ ਵਗੈਰਾ ਖੋਆ ਵਗੈਰਾ ਵਧੀਆ ਮਿਲਦਾ ਜੀ ਉਹਨਾਂ ਕੋਲ

ਹਾਂਜੀ ਹਾਂ ਹਾਜੀ ਹਾਂ ਗੱਲ ਐਵੇਂ ਹੈ ਨਾ ਵੀ ਅੱਜ ਕੱਲ੍ਹ ਮਿਲਾਵਟੀ ਬਹੁਤ ਦੇ ਰਹੇ ਨੇ ਹੈਗੇ ਨਕਲੀ ਪਨੀਰ ਨਕਲੀ ਖੋਆ ਨਕਲੀ ਘਿਓ ਹੈ ਨਾ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਅੱਛਾ ਉਹ ਘਰ ਅੱਛਾ ਦੁੱਧ ਕੀ ਰੇਟ ਦਿੰਦੇ ਜੀ ਉਹ ਹਾਂਜੀ ਠੀਕ ਹੈ ਜੀ ਉਹ ਘਰ ਤਾਂ ਨਹੀਂ ਦੇ ਕੇ ਜਾਂਦੇ ਜਾਂ ਫਿਰ ਉੱਥੋਂ ਲੈ ਕੇ ਆਉਣਾ ਪਊਗਾ ਸਾਨੂੰ ਜਾ ਕੇ ਹੂੰ ਅੱਛਾ ਜੀ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਠੀਕ ਹੈ ਚਲੋ ਫਿਰ ਅਸੀਂ ਉਹਨਾਂ ਤੋਂ ਲੈ ਲੈਂਦੇ ਹਾਂ ਜਾ ਕੇ ਠੀਕ ਹੈ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਓਕੇ